ਸਭ ਤੋਂ ਪਹਿਲਾਂ ਕੱਪੜੇ ਨੂੰ ਅਸੀਂ ਫੈਬਰਿਕ ਵੇਖਾਂਗੇ ਤੇ ਉਸਦਾ ਦੇਖਾਂਗੇ ਵੀ ਇਸਦਾ ਕੀ ਬਣ ਸਕਦਾ ਸੂਟ ਬਣ ਸਕਦਾ ਪਲਾਜੋ ਸੂਟ ਬਣ ਸਕਦਾ ਜਾਂ ਕੋਈ ਸ਼ਰਾਰਾ ਸੂਟ ਬਣ ਸਕਦਾ ਐ ਉਸ ਤੋਂ ਬਾਅਦ ਮੈਂ ਆਪਦੀ ਬੇਟੀ ਤੋਂ ਜਾਂ ਆਪਦੀ ਸਹੇਲੀ ਤੋਂ ਵੀ ਸਲਾਹ ਲੈ ਸਕਦੀ ਆਂ ਆਨਲਾਈਨ ਵੀ ਸਲਾਹ ਲੈ ਸਕਦੀ ਆਂ ਫਿਰ ਉਸ ਤੋਂ ਬਾਅਦ ਉਹਦੇ ਤੇ ਕੀ ਲੱਗਣਾ ਲੈਸ਼ ਲੱਗਦੀ ਏ ਜਾ ਮੋਤੀ ਲੱਗ ਸਕਦੇ ਨੇ ਜਾਂ ਕੋਈ ਸਟਾਰ ਲੱਗ ਸਕਦੇ ਨੇ ਇਹ ਵੀ ਚੀਜ਼ ਵੇਖਣੀ ਏ ਉਹਦਾ ਕੀ ਲੱਗ ਸਕਦਾ ਉਹਦੇ ਤੇ ਫਿਰ ਉਸ ਤੋਂ ਬਾਅਦ ਉਹਦਾ ਡਿਜ਼ਾਇਨ ਬਣਾ ਕੇ ਕਾਂਗਜ਼ ਤੇ ਉਤਾਰ ਕੇ ਵੇਖਦੇ ਆਂ ਅਸੀਂ ਵੀ ਇਹਦਾ ਕੀ ਸਹੀ ਲੱਗੇਗਾ ਇਹਦਾ ਗਲਾ ਬਾਜੂ ਜਾ ਉਹਦੀ ਲੈਂਥ ਕਿੰਨੀ ਬਣ ਸਕਦੀ ਏ ਲੈਂਥ ਵੀ ਚੈੱਕ ਕਰਨੀ ਏ ਸੂਟ ਦੀ ਪਲਾਜੋ ਦੀ ਜਾ ਸਲਵਾਰ ਦੀ ਕੋਈ ਵੀ ਕੀ ਬਣਾਉਣਾ ਅਸੀਂ ਇਹ ਚੀਜ਼ ਦੋ ਕੁਛ ਵੀ ਮਤਲਬ ਬਣਾਣਾ ਤੇ ਉਹ ਬਣਾ ਕੇ ਅਸੀਂ ਇਹ ਚੀਜ਼ ਤੈਅ ਕਰਨੀ ਬਾਦ ਚ ਵੀ ਇਹਦਾ ਕੀ ਬਣੇਗਾ ਫਿਰ ਉਸ ਤੋਂ ਬਾਅਦ ਅਸੀਂ ਬਣਾਉਣਾ ਸ਼ੁਰੂ ਕਰਾਂਗੇ